ਇੱਕ ਵਿਅਕਤੀ ਦੇ ਜੀਵਨ ਵਿੱਚ ਗੁਰੂ ਦੀ ਭੂਮਿਕਾ ਉੱਨੀ ਹੀ ਮਹੱਤਵਪੂਰਨ ਹੁੰਦੀ ਹੈ ਜਿੰਨੀ ਇੱਕ ਵਿਦਿਆਰਥੀ ਦੇ ਜੀਵਨ ਵਿੱਚ ਉਸ ਦੇ ਅਧਿਆਪਕ ਦੀ ਮਹੱਤਵਪੂਰਨਤਾ ਹੁੰਦੀ ਹੈ ਕਿਤੇ ਵੀ ਆਪਾਂ ਨੂੰ ਪਹੁੰਚਣ ਲਈ ਕਿਸੇ ਵੀ ਮੰਜ਼ਿਲ 'ਤੇ ਪਹੁੰਚਣ ਲਈ ਆਪਾਂ ਨੂੰ ਗੁਰੂ ਦੀ ਇੱਕ ਸੇਧ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਿੱਦਾਂ ਕਿ ਆਪਣੇ ਗੁਰਦੁਆਰਾ ਸਾਹਿਬ ਵਿੱਚ ਆਪਾਂ ਜਾਂਦੇ ਹਾਂ ਤਾਂ ਉੱਥੇ ਆਪਾਂ ਨੂੰ ਜਾਣ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਦੇਣਾ ਜ਼ਰੂਰੀ ਹੈ ਜਿਦ ਜਿਵੇਂ ਕਿ ਇੱਕ ਸਿਰ ਢੱਕ ਕੇ ਰ ਜਾਣਾ ਚਾਹੀਦਾ ਹੈ ਆਪਣੀ ਜਿਹੜੀਆਂ ਜੁਰਾਬਾਂ ਉਹ ਉਤਾਰ ਕੇ ਜਾਣਾ ਚਾਹੀਦਾ ਸਾਫ ਸੁਥਰੇ ਇਸ਼ਨਾਨ ਕਰਕੇ ਜਾਣਾ ਚਾਹੀਦਾ ਹੈ ਅਤੇ ਉੱਥੇ ਆਪਾਂ ਨੂੰ ਮੱਥਾ ਇੱਕਮਨਾਣ ਨਿਮਰਤਾ ਨਾਲ ਟੇਕਣਾ ਚਾਹੀਦਾ ਹੈ ਜਾ ਕੇ ਟੇਕ ਕੇ ਬੈਠਣਾ ਚਾਹੀਦਾ ਹੈ ਤੇ ਲਾਈਨ 'ਚ ਲੱਗ ਕੇ ਹੀ ਆਪਾਂ ਨੂੰ ਲੰਗਰ ਅਤੇ ਪ੍ਰਸ਼ਾਦ ਦੋਨੋਂ ਛਕਣੇ ਚਾਹੀਦੇ ਹਨ